ਹਾਂਜੀ ਨਮਸਕਾਰ ਜੀ ਨਮਸਕਾਰ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਇਥੇ ਹਿਸਟੋਰੀਕਲ ਪਲੇਸ ਸਾਡੇ ਇਤਿਹਾਸ ਨਾਲ ਜੁੜੇ ਹੋਏ ਕਾਫੀ ਆ ਇਥੇ ਅਨੰਦਪੁਰ ਸਾਹਿਬ ਆ ਉੱਥੇ ਦਾ ਹੋਲਾ ਮਹੱਲਾ ਬਹੁਤ ਮਸ਼ਹੂਰ ਆ ਅਤੇ ਫਤਿਹਗੜ੍ਹ ਸਾਹਿਬ ਆ ਇਥੇ ਪਟਿਆਲੇ ਹੈਗੇ ਕਾਲੀ ਮਾਤਾ ਦਾ ਮੰਦਿਰ ਆ ਅਤੇ ਆਪਣੇ ਅੰਮ੍ਰਿਤਸਰ ਹੈਗਾ ਹਰਿਮੰਦਰ ਸਾਹਿਬ ਆ ਉਥੇ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਬਣਿਆ ਹੋਇਆ ਆ ਅਤੇ ਉਹ ਸਾਡੇ ਸੰਸਾਰ ਦੇ ਵਿੱਚ ਕਾਫੀ ਮਸ਼ਹੂਰ ਆ ਲੋਕੀ ਬਾਹਰਲੇ ਦੇਸ਼ਾਂ ਤੋਂ ਵੀ ਉਹ ਦੇਖਣ ਨੂੰ ਆਉਂਦੇ ਆ ਅਤੇ ਬਾਕੀ ਚਮਕੌਰ ਸਾਹਿਬ ਆ ਸਰਹੰਦ ਆ ਇਹ ਸਾਡੇ ਸਾਰੇ ਕਾਫੀ ਮਸ਼ਹੂਰ ਅਤੇ ਜਿਹੜੇ ਸਾਡੇ ਦੇਸ਼ ਦੇ ਇਤਿਹਾਸ ਦੇ ਨਾਲ ਜੁੜੇ ਹੋਏ ਆ ਇਹ ਸਾਰਾ ਕੁਝ ਇਤਿਹਾਸ ਨਾਲ ਜੁੜਿਆ ਹੋਇਆ ਸਾਡੇ ਜਦੋਂ ਤੁਸੀਂ ਆਓਂਗੇ ਤੁਹਾਨੂੰ ਦੇਖਣ ਨੂੰ ਵੀ ਵਧੀਆ ਲੱਗੂਗਾ ਅਤੇ ਸਾਡੇ ਇਤਿਹਾਸ ਦੀ ਜਾਣਕਾਰੀ ਵੀ ਸਾ ਸਾਨੂੰ ਮਿਲੂਗੀ ਹਾਂਜੀ ਅਛ ਹਾਂਜੀ ਤੁਸੀਂ ਜਦੋਂ ਵੀ ਆਉਂਗੇ ਤੁਸੀਂ ਮੈਨੂੰ ਪਹਿਲਾਂ ਕੋਲ ਕਰ ਦਿਓ ਮੈਨੂੰ ਦੱਸ ਦਿਓ ਵੀ ਅਸੀਂ ਤੁਹਾਡੇ ਨਾਲ ਜਾਵਾਂਗੇ ਅਤੇ ਤੁਹਾਨੂੰ ਉਹ ਉਹਦੇ ਇਤਿਹਾਸ ਦੁਆਰਾ ਵੀ ਦੱਸਾਂਗੇ ਇਹਦਾ ਕੀ ਕੀ ਇਤਿਹਾਸ ਆ ਹਾਂਜੀ ਹਾਂਜੀ ਮੋਸਟ ਵੈਲਕਮ ਜਦੋਂ ਮਰਜੀ ਆਓ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਇੱਧਰ ਠੀਕ ਹੈ ਜੀ ਵੈਲਕਮ ਓਕੇ ਓਕੇ ਵੈਲਕਮ ਜੀ